ਹੈਲੋ ਵਧੀਆ ਵਧੀਆ ਤੁਸੀਂ ਦੱਸੋ ਕੁਛ ਨਹੀਂ ਬਸ ਹੋਰ ਹਾਂ ਹਾਂ ਅੱਛਾ ਕੀ ਪੁੱਛਣਾ ਸੀ ਹਾਂ ਹਾਂ ਗੁਰਦੁਆਰਾ ਸਾਹਿਬ ਮੇਨ ਫਤਿਹਗੜ੍ਹ ਸਾਹਿਬ ਹੈ ਇੱਕ ਤਾਂ ਇੱਕ ਜੋਤੀ ਸਰੂਪ ਆ ਜਾਂਦਾ ਆ ਹਾਂ ਹਾਂਜੀ ਹਾਂ ਹਾਂਜੀ ਧਾਰਮਿਕ ਉਹ ਬਹੁਤ ਲੋਕ ਬਹੁਤ ਹੀ ਸ਼ਰਧਾ ਨਾਲ ਮੰਨਦੇ ਆ ਲੋਕ ਆਉਂਦੇ ਆ ਉਹਨਾਂ ਦੀਆਂ ਪੂ ਮਨੋਕਾਮਨਾ ਪੂਰਨ ਹੁੰਦੀਆਂ ਨੇ ਉਸ ਤੋਂ ਬਾਅਦ ਜੋਤੀ ਸਰੂਪ ਦੀ ਗੱਲ ਕਰੀਏ ਜਿਵੇਂ ਜੋਤੀ ਸਰੂਪ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਹਨਾਂ ਦੇ ਸੰਸਕਾਰ ਕਰਨ ਵਾਸਤੇ ਜਗ੍ਹਾ ਵੀ ਨਹੀਂ ਸੀ ਵੀ ਕਿੱਦਾਂ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਹਾਂਜੀ ਹਾਂ ਜੀ ਹਾਂਜੀ ਹਾਂਜੀ ਹਾਂ ਆਹ ਤਾਂ ਮੇਨ ਗੁਰਦੁਆਰਾ ਸਾਹਿਬ ਆ ਪਰ ਜੋਤੀ ਸਰੂਪ ਦੇ ਵਿੱਚ ਜਿੱਦਾਂ ਮਤਲਬ ਉਹਨਾਂ ਨੇ ਮੋਹਰਾਂ ਵਿਛਾ ਕੇ ਕਿੱਦਾਂ ਉਨੀ ਜਗ੍ਹਾ ਖਰੀਦੀ ਦੁਨੀਆਂ ਦੀ ਸਾਰਿਆਂ ਨਾਲੋਂ ਉਹ ਅਮੀਰ ਜਗ੍ਹਾ ਮਤਲਬ ਸਾਰਿਆਂ ਨਾਲੋਂ ਮਹਿੰਗੀ ਜਗ੍ਹਾ ਆ ਬੁੱਕ ਦੇ ਵਿੱਚ ਵੀ ਰਿਕੋਡ ਉੱਥੇ ਸੰਸਕਾਰ ਕੀਤਾ ਸੀ ਇਸ ਤੋਂ ਸਿਵਾ ਵੀ ਬਹੁਤ ਕੁਝ ਆ ਫਤਿਹਗੜ ਸਾਹਿਬ ਦੇ ਵਿੱਚ ਆਮ ਖਾਸ ਬਾਗ ਆ ਹਾਂ ਜਿਵੇਂ ਹੁਣ ਆਮ ਖਾਸ ਬਾਗ ਸਾਰਿਆਂ ਨਾਲੋਂ ਪਹਿਲਾਂ ਅਕਬਰ ਨੇ ਬਣਵਾਇਆ ਸੀਗਾ ਬਟ ਇੱਕ ਯੂਜ ਨਹੀਂ ਜਾਂਦਾ ਸੀ ਅਤੇ ਬਾਅਦ 'ਚ ਸ਼ਾਹਜਹਾਂ ਨੇ ਉਹਨੂੰ ਰੀਬਿਲਟ ਕੀਤਾ ਸੀ ਅਤੇ ਜਿਹੜਾ ਯੂਜ ਕੀਤਾ ਔਰ ਜਹਾ ਹਾਂ ਜਹਾਂਗੀਰ ਹੀ ਹਾਂ ਹਾਂ ਮਤਲਬ ਕਿ ਸੈਂਟਰ ਆਉਂਦਾ ਸੀ ਨਾ ਫਿਰ ਇੱਥੇ ਰਹਿੰਦੇ ਹੁੰਦੇ ਸੀਗੇ ਮਤਲਬ ਕਿ ਬਹੁਤ ਹੀ ਜ਼ਿਆਦਾ ਬੜਾ ਆ ਬਹੁਤ ਪੁਰਾਣਾ ਆ ਇਤਿਹਾਸ ਬਹੁਤ ਜ਼ਿਆਦਾ ਲੋਕਾਂ ਨੂੰ ਹੁਣ ਬਹੁਤ ਜ਼ਿਆਦਾ ਵਧੀਆ ਲੱਗਦਾ ਦੇਖਣਾ ਵੈਂਟੀਲੇਸ਼ਨ ਬਹੁਤ ਵਧੀਆ ਆ

ਹੋਰ ਹਾਂ ਹਾਂ ਉਸ ਤੋਂ ਸਿਵਾ ਰੋਜ਼ਾ ਮਸਜਿਦ ਵੀ ਹੈ ਜਿਹਦੀ ਬਹੁਤ ਜ਼ਿਆਦਾ ਪੁਰਾਣੀ ਆ ਹਾਂ ਅੱਛਾ ਅੱਛਾ ਅੱਛਾ ਠੀਕ

ਹਾਂਜੀ ਹਾਂ ਵਧੀਆ ਹਾਂ ਹੋਰ ਹੋਰ ਜਿਵੇਂ ਰੋਜ਼ਾ ਮਸਜਿਦ ਏ ਆ ਉਹਦਾ ਵੀ ਬਹੁਤ ਪੁਰਾਣਾ ਇਤਿਹਾਸ ਬਹੁਤ ਪੁਰਾਣੀ ਉਹ ਇਮਾਰਤ ਆ ਇਸ ਤੋਂ ਸਿਵਾ ਜੈਨ ਮੰਦਰ ਹੋਰ ਬਹੁਤ ਕੁਛ ਆ ਮਤਲਬ ਬਹੁਤ ਹੀ ਜਗ੍ਹਾ ਨੇ ਜਿਹੜੀਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਫੇਮਸ ਨੇ ਅਤੇ ਇਤਿਹਾਸ ਹਾਂ ਇਹ ਤਾਂ ਹੈ ਹੋਰ ਚਲੋ ਹਾਂ ਹਾਂ ਚਲੋ ਸਹੀ ਆ ਫਿਰ ਮਿਲਦੇ ਕਦੇ ਠੀਕ